ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਅਤੇ ਮੈਂ ਭਾਅ ਜੀ ਆ ਐਕਚੁਲੀ ਇੱਧਰੋਂ ਆਇਆ ਹੋਇਆਂ ਆ ਜੰਮੂ 'ਚੋਂ ਅਤੇ ਮੈਂ ਆਪਣਾ ਨਾ ਇੱਧਰ ਪਟਿਆਲੇ ਆਉਣਾ ਸੀਗਾ ਘੁੰਮਣ ਸੁਣਿਆ ਵੀ ਰੋਇਲ ਸਿਟੀ ਕਹਿੰਦੇ ਨੇ ਪਟਿਆਲੇ ਨੂੰ ਹੈ ਨਾ ਅਤੇ ਯਾਰ ਦੇਖਣਾ ਵੀ ਇੱਥੇ ਕਿੱਦਾਂ ਕਿੱਦਾਂ ਦਾ ਮਾਹੌਲ ਆ ਜਾਂ ਕੀ ਕੀ ਹੈਗਾ ਚੀਜ਼ ਘੁੰਮਣ ਦੇ ਲਈ ਅਤੇ ਇੱਥੇ ਵੈਸੇ ਨੇਚਰ ਪਾਰਕ ਜਾਂ ਨੇਚਰ ਗਾਈਡ ਬਾਰੇ ਕਰ ਸਕਦੇ ਵੀ ਇੱਥੇ ਕਿੱਦਾਂ ਜਾਂ ਕੀ ਚੀਜ਼ਾਂ ਹੈਗੀਆਂ ਅੱਛਾ ਅੱਛਾ ਵੀਰੇ ਬਾਰਾਦਰੀ ਗਾਰਡਨ ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਅੱਛਾ ਅੱਛਾ ਵੀਰੇ ਇਹ ਕਿੱਥੇ ਕੁ ਹੈ ਅੱਛਾ ਅੱਛਾ ਜੀ ਠੀਕ ਹੈ ਜੀ ਅੱਛਾ ਅੱਛਾ ਜੀ ਥਾਪਰ ਯੂਨੀਵਰਸਿਟੀ ਕਿੱਥੇ ਕੁ ਕਰਕੇ ਹੈ ਜੀ ਅੱਛਾ ਅੱਛਾ ਇਹ ਵੀ ਟੂਰਿਸਟ ਵਾਸਤੇ ਆ ਜਾਂ ਵੈਸੇ ਯੂਨੀਵਰਸਿਟੀ ਆ ਇਹ ਅੱਛਾ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਅੱਛਾ ਅੱਛਾ ਅੱਛਾ ਜੀ ਸਮਝ ਗਿਆ ਜੀ ਮੈਂ ਸਮਝ ਗਿਆ ਠੀਕ ਆ ਠੀਕ ਆ ਠੀਕ ਆ ਜੀ ਕੋਈ ਚੱਕਰ ਨਹੀਂ ਅਤੇ ਮੈਂ ਤਾਂ ਪਤਾ ਕਰਿਆ ਸੀਗਾ ਜੀ ਬਸ ਇਹੀ ਪਤਾ ਕਰਿਆ ਸੀਗਾ ਵੀ ਮੈਖਾਂ ਚਲੋ ਦੇਖੀਏ ਪਤਾ ਕਰਕੇ ਵੀ ਕਹਿੰਦੇ ਨੇ ਪਟਿਆਲੇ ਨੂੰ ਅਤੇ ਮੈਂ ਕਿਹਾ ਵੀ ਹੈਗਾ ਵੀ ਇੱਥੇ ਗਾਰਡਨ ਗੂਰਡਨ ਜਾਂ ਕਿੱਦਾਂ ਨੇ ਵੀ ਵਧੀਆ ਆਪਣਾ ਫੈਮਲੀ ਨੂੰ ਜਿੱਦਾਂ ਮਤਲਬ ਠੀਕ ਆ ਵੀ ਇੱਦਾਂ ਹੁੰਦਾ ਵੀ ਜਿਵੇਂ ਠੀਕ ਹੈ ਜੀ ਠੀਕ ਹੈ ਕਿਉਂਕਿ ਹੁਣ ਅਸੀਂ ਇੱਧਰ ਜਿਵੇਂ ਹੁੰਦੇ ਹਾਂ ਸਾਨੂੰ ਸਵੇਰੇ ਸ਼ਾਮ ਜੋਗਿੰਗ ਜਾਂ ਐਕਸਰਸਾਈਜ਼ ਕਰਨ ਦਾ ਚੋਅ ਹੁੰਦਾ ਫਿਰ ਜਿਵੇਂ ਨੇਚਰ ਪਾਰਕ ਵਧੀਆ ਚੀਜ਼ਾਂ ਹੁੰਦੀਆਂ ਨੇ ਘੁੰਮਣ ਫਿਰਨ ਨੂੰ ਛੋਟੀ ਬਾਰਾਦਰੀ ਵੱਡੀ ਵੀ ਹੈ ਕੋਈ

ਅੱਛਾ ਜਿੰਮ ਦਾ ਸਮਾਨ ਵੀ ਹੈਗਾ ਉੱਥੇ ਚਲੋ ਵਧੀਆ ਜੀ ਵਧੀਆ ਠੀਕ ਹੈ ਠੀਕ ਹੈ ਜੀ ਥੈਂਕ ਯੂ ਜੀ ਫਿਰ ਮੈਂ ਕਰਦਾਂ ਗੱਲ ਤੁਹਾਡੇ ਨਾਲ ਠੀਕ ਹੈ ਜੀ ਥੈਂਕ ਯੂ